ਸਾਡਾ ਭਾਰਤੀ ਮੀਡੀਆ ਬਹੁਤਾ ਵਧੀਆ ਨਹੀਂ ਹੈ ਇਸ ਨੂੰ ਵਿਸ਼ਵ ਦੇ ਮੀਡੀਆ ਵਿੱਚ ਵੀ ਕੁਛ ਬਹੁਤਾ ਵਧੀਆ ਰੈਂਕ ਨਹੀਂ ਮਿਲਿਆ ਇਹ ਸਭ ਤੋਂ ਪਿੱਛੇ ਰਿਹਾ ਹੈ ਸਾਡਾ ਭਾਰਤੀ ਮੀਡੀਆ ਸਿਰਫ ਗੋਦੀ ਮੀਡੀਆ ਬਣ ਕੇ ਰਹਿ ਚੁੱਕਿਆ ਹੈ ਇਹ ਸਿਰਫ ਮੋਦੀ ਦੀ ਵਾਹ ਵਾਹ ਕਰਨ ਵਾਲਾ ਹੀ ਮੀਡੀਆ ਹੈ ਇਹ ਹਮੇਸ਼ਾਂ ਮੋਦੀ ਦੀ ਸਪੋਰਟ ਵਿੱਚ ਹੀ ਬੋਲਦਾ ਹੈ ਅਤੇ ਝੂਠੀਆਂ ਖਬਰਾਂ ਦਿਖਾਉਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਮੈਂ ਭਾਰਤੀ ਮੀਡੀਆ ਦੇਖਣਾ ਪਸੰਦ ਤਾਂ ਨਹੀਂ ਕਰਦਾ ਪ੍ਰੰਤੂ ਫਿਰ ਵੀ ਅੱਜ ਤੱਕ ਏਬੀਪੀ ਨਿਊਜ਼ ਨਿਊਜ਼ ਏਟੀਨ ਹਰਿਆਣਾ ਹਿਮਾਚਲ ਬਾਰੇ ਪਤਾ ਹੈ ਪ੍ਰੰਤੂ ਮੈਨੂੰ ਇਹ ਸਭ ਚੈਨਲ ਵਧੀਆ ਨਹੀਂ ਲੱਗਦੇ ਮੈਨੂੰ ਸਿਰਫ ਰਾਜ ਦੇ ਜਿਹੜੇ ਆਪਣੇ ਚੈਨਲ ਹੁੰਦੇ ਹਨ ਉਹੀ ਦੇਖਣੇ ਵਧੀਆ ਲੱਗਦੇ ਹਨ ਭਾਰਤੀ ਮੀਡੀਆ ਨੂੰ ਵਿਸ਼ਵ ਰੈਂਕ ਵਿੱਚ ਵੀ ਕੁਝ ਬਹੁਤਾ ਵਧੀਆ ਰੈਂਕ ਨਹੀਂ ਮਿਲਿਆ